ਸਾਡੇ ਸਮਾਜ ਵਿੱਚ ਬਹੁਤ ਜ਼ਿਆਦਾਤਰ ਲੋਕ ਧਰਮ ਨੂੰ ਮੰਨਣ ਵਾਲੇ ਹਨ ਅਤੇ ਇਹ ਕਈ ਤਰ੍ਹਾਂ ਨਾਲ਼ ਆਪਣੇ ਧਰਮ ਨੂੰ ਮੰਨਦੇ ਹਨ ਜਿਵੇਂ ਕਿ ਰੰਗੋਲੀ ਬਣਾਉਣਾ ਰੰਕੋ ਰੰਗੋਲੀ ਬਣਾਉਣਾ ਇਹ ਬਹੁਤ ਹੀ ਸ਼ੁੱਭ ਮੰਨੀ ਜਾਂਦੀ ਹੈ ਇਹ ਖਾਸ ਕਰਕੇ ਤਿਉਹਾਰਾਂ ਦੇ ਮੌਕੇ 'ਤੇ ਬਣਾਈ ਜਾਂਦੀ ਹੈ ਇਸ ਨਾਲ਼ ਕਹਿੰਦੇ ਹਨ ਕਿ ਘਰ ਵਿੱਚ ਖੁਸ਼ੀਆਂ ਆਉਂਦੀਆਂ ਹਨ ਅਤੇ ਕਈ ਲੋਕ ਸਵੇਰੇ ਉੱਠ ਕੇ ਸੂਰਜ ਨੂੰ ਪਾਣੀ ਦਿੰਦੇ ਹਨ ਇਸ ਨਾਲ਼ ਮੰਨਿਆ ਜਾਂਦਾ ਹੈ ਕਿ ਸਾਡੇ ਸਾਰੇ ਮਾੜੇ ਗ੍ਰਹਿ ਦੂਰ ਹੋ ਜਾਂਦੇ ਹਨ ਅਤੇ ਮੱਥੇ 'ਤੇ ਸੰਧੂਰ ਲਾਉਂਦੇ ਹਨ ਮੱਥੇ 'ਤੇ ਸੰਧੂਰ ਲਾਉਣ ਦਾ ਮਤਲਬ ਹੈ ਵੀ ਅਸੀਂ ਬਸ ਸਾਡੀ ਆਪਣੀ ਮਾਨਤਾ ਹੈ ਵੀ ਅਸੀਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਰੱਬ ਦੇ ਨੇੜੇ ਮੰਨਦੇ ਹਾਂ ਅਤੇ ਅਸੀਂ ਆਪਣੇ ਬੱਚਿਆਂ ਦੇ ਕਈ ਤਰ੍ਹਾਂ ਦੇ ਧਾਗੇ ਬੰਨਦੇ ਹਾਂ ਉਹ ਤਾਂ ਅੱਗੇ ਬੰਨਣ ਨਾਲ਼ ਸਾਡੇ ਮਨ ਨੂੰ ਤਸੱਲੀ ਮਿਲਦੀ ਹੈ ਕਿ ਅਸੀਂ ਆਪਣੀਆਂ ਬੱਚਿਆਂ ਨੂੰ ਬੁਰੀਆਂ ਨਜ਼ਰਾਂ ਤੋਂ ਬਚਾ ਲਵਾਂਗੇ ਅਤੇ ਅਸੀਂ ਪੂਜਾ ਕਰਨ ਲਈ ਮੰਦਰ ਜਾਂਦੇ ਹਾਂ ਦਰਗਾਹ 'ਤੇ ਜਾਂਦੇ ਹੈਂ ਅਤੇ ਕਈ ਤਰ੍ਹਾਂ ਦੇ ਵਰਤ ਵੀ ਰੱਖਦੇ ਹਾਂ ਬਸ ਇਹ ਸਾਰੀਆਂ ਗੱਲਾਂ ਸਾਡੇ ਆਪਣੇ ਮਨ ਦੀ ਤਸੱਲੀ ਲਈ ਹੁੰਦੀਆਂ ਹਨ ਅਤੇ ਸਾਨੂੰ ਲੱਗਦਾ ਹੈ ਵੀ ਸਾਡੀ ਜ਼ਿੰਦਗੀ ਚੰਗੀ ਤਰ੍ਹਾਂ ਖੁਸ਼ਹਾਲ ਲੰਘ ਜਾਵੇਗੀ